ਕੜਾਹੀ ਕੁੱਕਰ ਪਤੀਲਾ ਕੜਾਹੀ ਜਿਹੜੀ ਹੈ ਅਸੀਂ ਸੁੱਕੀਆਂ ਸਬਜ਼ੀਆਂ ਬਣਾਉਣ ਦੇ ਵਿੱਚ ਵਰਤੀ ਜਾਂਦੀ ਹੈ ਕੁੱਕਰ ਜਿਹੜਾ ਹੈ ਜਿਹੜੀਆਂ ਚੀਜ਼ਾਂ ਨੂੰ ਅਸੀਂ ਸਟੀਮ ਕਰਕੇ ਬਣਾਉਂਦੇ ਹਾਂ ਜਿਸ ਤਰ੍ਹਾਂ ਰਾਜਮਾ ਛੋਲੇ ਜਿਹਨਾਂ ਨੂੰ ਸਟੀਮ ਦੇਣੀ ਹੁੰਦੀ ਹੈ ਉਹਨਾਂ ਨੂੰ ਅਸੀਂ ਕੁੱਕਰ ਦੇ ਵਿੱਚ ਬਣਾਉਂਦੇ ਹਾਂ ਪਤੀਲੇ ਵਿੱਚ ਅਸੀਂ ਉਹ ਚੀਜ਼ਾਂ ਰੱਖਦੇ ਹਨ ਜਿਹਨਾਂ ਨੂੰ ਅਸੀਂ ਉਬਾਲਣਾ ਹੁੰਦਾ ਹੈ ਜਿਸ ਨੂੰ ਬੋਇਲ ਕਰਨਾ ਹੁੰਦਾ ਜਿਸ ਤਰ੍ਹਾਂ ਦੁੱਧ ਹੋਇਆ ਜਾਂ ਕੋਈ ਹੋਰ ਚੀਜ਼ ਹੋਈ ਜਿਸ ਨੂੰ ਬੋਇਲ ਕਰਨਾ ਜਿੱਦਾਂ ਚਾਹ ਹੋਈ ਦੁੱਧ ਹੋਇਆ ਅਸੀਂ ਪਤੀਲੇ ਦਾ ਯੂਜ ਕੀਤਾ ਜਾਂਦਾ ਹੈ ਕੜਛੀ ਜਿਹੜੀ ਹੈ ਅਸੀਂ ਹਮੇਸ਼ਾ ਹੀ ਸਬਜ਼ੀ ਪਾਉਣ ਲਈ ਯੂਜ ਕੀਤਾ ਜਾਂਦਾ ਹੈ ਅਤੇ ਪੋਣੀ ਦਾ ਇਸਤੇਮਾਲ ਅਸੀਂ ਹਮੇਸ਼ਾ ਪੂਰੀਆਂ ਕੱਢਣ ਲਈ ਜਾਂ ਛਾਨਣ ਲਈ ਕੀਤਾ ਜਾਂਦਾ ਹੈ